ਮੈਂ ਅੰਗਰੇਜ ਸਿੰਘ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਕਿਸੇ ਮੌਜ ਦੇ ਨਾਲ ਦੌੜਦੇ ਹੋਏ ਜਾਂ ਕਿਸੇ ਚੱਲ ਰਹੇ ਕਲੱਬ ਵਿੱਚ ਸ਼ਾਮਲ ਹੋਏ ਹੋਣ ਉਹ ਅਨੁਭਵ ਕਿਹੋ ਜਿਹਾ ਸੀ ਜੇ ਨਹੀਂ ਤਾਂ ਕੀ ਤੁਸੀਂ ਚਾਹੁੰਦੇ ਹੋ ਤਾਂ ਕਿਹੋ ਜਿਹਾ ਸਮੂਹ ਵਿੱਚ ਦੌੜਨ ਦੇ ਕਈ ਫ਼ਾਇਦੇ ਮਿਲਦੇ ਹਨ ਮੋਟੀਵੇਸ਼ਨ ਲੋਕ ਦੇ ਨਾਲ ਦੌੜਨ ਲੋਕਾਂ ਦੇ ਨਾਲ ਦੌੜਨ ਨਾਲ ਪ੍ਰੇਰਨਾ ਮਿਲਦੀ ਹੈ ਜੋ ਕਿਸੇ ਹੱਦ ਤੱਕ ਸਿਵ ਡਿਪਲੇਸ਼ਨ ਵਿੱਚ ਬਣਾਉਂਦੀ ਹੈ ਸਮਾਜ ਸਬੰਧੀ ਸਮਾਜ ਸੰਬੰਧੀ ਦੌੜਨ ਦੇ ਦੌਰਾਨ ਨਵੀਆਂ ਦੋਸਤੀਆਂ ਬਣਾਉਣ ਨੂੰ ਮਿਲਦੀਆਂ ਹਨ ਦੋਸਤ ਮਿਲਦੇ ਹਨ ਦੋਸਤਾਂ ਦੇ ਵਿੱਚ ਭੱਜਣ ਲਈ ਆਪਾਂ ਨੂੰ ਸਿੱਖਣ ਨੂੰ ਬਹੁਤ ਕੁਛ ਮਿਲਦਾ ਹੈ ਜੋ ਕਿ ਆਪਣੇ ਸਿਹਤਮੰਦ ਜਾਲ ਮਨਾਉਂਦੀ ਹੈ ਆਪਾਂ ਨੂੰ ਦੌੜ ਜਾਲ ਵਿੱਚ ਦੌੜਨ ਨਾਲ ਇਹ ਵੀ ਗਿਆਨ ਮਿਲਦਾ ਹੈ ਕਿ ਆਪਾਂ ਨੂੰ ਪਹਿਲਾਂ ਕਿਵੇਂ ਭੱਜਣਾ ਚਾਹੀਦਾ ਅਤੇ ਬਾਅਦ ਵਿੱਚ ਕਿਵੇਂ ਭੱਜਣਾ ਚਾਹੀਦਾ ਅਤੇ ਨਾਲ ਨਾਲ ਆਪਣੇ ਨਵੇਂ ਦੋਸਤ ਵੀ ਬਣਦੇ ਹਨ ਸਿਹਤ ਲਾਭ ਦੌੜ ਦੌਰਾਨ ਵਿੱਚ ਭਾਗ ਲੈਣ ਨਾਲ ਸਰੀਰਕ ਡੀਪਰੈਸ਼ਨ ਵਿੱਚ ਵਾਧਾ ਹੁੰਦਾ ਹੈ ਟਰੇਨਿੰਗ ਕੋਚ ਜਾਂ ਅਨੁਭਵੀ ਦੌੜ ਜਾ ਕੇ ਦੌੜ ਜਾ ਕੇ ਨਾਲ ਸਿੱਖਣ ਲਈ ਮਿਲਦਾ ਹੈ ਜਿਸ ਨਾਲ ਤੇਜ਼ੀ ਅਤੇ ਸ਼ਕਤੀ ਵਿੱਚ ਸੁਧਾਰ ਆ ਸਕਦਾ ਹੈ ਜੇ ਤੁਸੀਂ ਜੇ ਤੁਸੀਂ ਅਜੇ ਤੱਕ ਸਮੂਹ ਵਿੱਚ ਦੌੜਦੇ ਨਹੀਂ ਹੋ ਤਾਂ ਇਹ ਇੱਕ ਵਧੀ ਵਧੀ ਅਨੁਭਵ ਹੋ ਸਕਦਾ ਹੈ ਇਹ ਇੱਕ ਵਧੀਆ ਅਨੁਭਵ ਹੋ ਸਕਦਾ ਹੈ ਤੁਹਾਨੂੰ ਦੋੜ ਵਿੱਚ ਦੋੜਨਾ ਚਾਹੀਦਾ ਹੈ ਜਾਂ ਤੁਹਾਨੂੰ ਆਪਣੇ ਦੋਸਤਾਂ ਦੇ ਨਾਲ ਦੌੜਨਾ ਚਾਹੀਦਾ ਹੈ